ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਨੁਭਵ ਰਿਹਾ ਸੀ ਜਦੋਂ ਮੈਂ ਨੌ ਸਾਲਾਂ ਦਾ ਹੁੰਦਾ ਸੀ ਇਹ ਅਨੁਭਵ ਹੈ ਦੋ ਹਜ਼ਾਰ ਗਿਆਰਾਂ ਕ੍ਰਿਕਟ ਵਰਲਡ ਕੱਪ ਦਾ ਸਭ ਤੋਂ ਵੱਡੀ ਗੱਲ ਕਿ ਉਹ ਇੱਕ ਤਾਂ ਕ੍ਰਿਕਟ ਹੀ ਜਿਹੜੀ ਮੇਰੀ ਸਭ ਤੋਂ ਪਸੰਦੀਦਾ ਚੀਜ਼ ਹੈ ਦੂਜੀ ਗੱਲ ਉਹ ਵਿਸ਼ਵ ਕੱਪ ਵਿੱਚ ਫਾਈਨਲ ਵਿੱਚ ਭਾਰਤ ਪੁੱਜਿਆ ਸੀ ਅਤੇ ਤੀਜੀ ਗੱਲ ਉਹ ਵਿਸ਼ਵ ਕੱਪ ਬਾਰਤ ਭਾਰਤ 'ਚ ਹੀ ਹੋ ਰਿਹਾ ਸੀ ਅਤੇ ਉਹਦਾ ਫਾਈਨਲ ਸੀ ਵਾਨਖੇੜੇ ਸਟੇਡੀਅਮ ਜੋ ਕਿ ਮਹਾਰਾਸ਼ਟਰ ਮੁੰਬਈ 'ਚ ਪੈਂਦਾ ਹੈ ਅਤੇ ਉਸ ਵਿੱਚ ਸਾਡੇ ਸਾਹਮਣੇ ਸੀ ਸ਼੍ਰੀ ਲੰਕਾ ਸ਼੍ਰੀ ਲੰਕਾ ਅਤੇ ਭਾਰਤ ਦਾ ਮੁਕਾਬਲਾ ਸੀ ਸਭ ਤੋਂ ਪਹਿਲਾਂ ਸ਼੍ਰੀ ਲੰਕਾ ਟੌਸ ਜਿੱਤਦੀ ਹੈ ਅਤੇ ਬੈਟਿੰਗ ਚੁਣਦੀ ਹੈ ਬੈਟਿੰਗ ਚੁਣਨ ਤੋਂ ਬਾਅਦ ਜਦੋਂ ਬੈਟਿੰਗ ਕਰਨ ਆਉਂਦੀ ਹੈ ਤਾਂ ਉਹਦੀ ਇੱਕ ਦੋ ਵਿਕੇਟਾਂ ਪਹਿਲੇ ਪੰਜ ਓਵਰਾਂ ਵਿੱਚ ਹੀ ਉੱਡ ਜਾਂਦੀਆਂ ਪਰ ਉਸ ਤੋਂ ਬਾਅਦ ਉਹਨਾਂ ਦੀ ਇੱਕ ਸਾਝੇਦਾਰੀ ਬਣ ਜਾਂਦੀ ਹੈ ਜਿਸ ਦੇ ਬਲ 'ਤੇ ਉਹ ਦੋ ਸੌ ਚੁਰਾਨਵੇਂ ਰਨ ਦਾ ਫਾਈਨਲ 'ਚ ਟਾਰਗੇਟ ਦਿੰਦੇ ਹਨ ਦੋ ਸੌ ਚੁਰਾਨਵੇਂ ਰਨ ਇੱਦਾਂ ਵੀ ਵੱਧ ਹੁੰਦੇ ਹਨ ਪਰ ਜਦੋਂ ਗੱਲ ਫਾਈਨਲ ਅਤੇ ਵਰਲਡ ਕੱਪ ਦੇ ਫਾਈਨਲ ਦੀ ਹੋਵੇ ਤਾਂ ਇਸ 'ਤੇ ਤੀਹ ਚਾਲੀ ਰਨ ਵਧਾ ਕੇ ਤੁਸੀਂ ਸਮਝੋ ਕਿ ਹੁੰਦਾ ਫਾਈਨਲ ਦਾ ਟਾਰਗੇਟ ਮੰਨੋ ਕਿ ਤਿੰਨ ਸੌ ਵੀਹ ਜਿੱਦਾਂ ਆ ਉੱਦਾਂ ਹੀ ਦੋ ਸੌ ਛਿਆਨਵੇਂ ਫਾਈਨਲ ਦਾ ਟਾਰਗੇਟ ਹੈ ਜਦ ਭਾਰਤ ਦੀ ਬੈਟਿੰਗ ਆਉਂਦੀ ਹੈ ਤਾਂ ਭਾਰਤ ਦੇ ਦੂਜੇ ਓਵਰ 'ਚ ਹੀ ਉਹਦੀ ਪਹਿਲੀ ਵਿਕਟ ਜੋ ਕਿ ਸਹਿਵਾਗ ਦੇ ਰੂਪ 'ਚ ਉੱਡ ਜਾਂਦੀ ਹੈ ਤਾਂ ਉਸ ਤੋਂ ਅਗਲੇ ਓਵਰ 'ਚ ਹੀ ਸਚਿਨ ਵੀ ਆਊਟ ਹੋ ਜਾਂਦੇ ਹਨ ਉਸ ਸਮੇਂ ਭਾਰਤ ਦੇ ਦੋ ਮੇਨ ਖਿਲਾੜੀਆਂ ਵਿੱਚੋਂ ਇਹ ਦੋ ਮੇਨ ਮੰਨੇ ਜਾਂਦੇ ਸੀ ਅਤੇ ਇਹ ਦੋਨਾਂ ਦੇ ਆਊਟ ਹੋਣ ਤੋਂ ਬਾਅਦ ਭਾਰਤ ਇੱਕ ਬਹੁਤ ਮੁਸ਼ਕਲ ਸਥਿਤੀ 'ਤੇ ਪੁੱਜ ਜਾਂਦਾ ਹੈ ਉਸ ਤੋਂ ਬਾਅਦ ਸਟਰਾਈਕ 'ਤੇ ਹੁੰਦੇ ਹਨ ਸੁਰੇਸ਼ ਰੈਨਾ ਅਤੇ ਦੂਜੇ ਸਾਡੇ ਹੁੰਦੇ ਹਨ ਗੋਤਮ ਗੰਭੀਰ ਗੋਤਮ ਗੰਭੀਰ ਸਾਝੇਦਾਰੀ ਬਣਾਉਂਦੇ ਹਨ ਸੁਰੇਸ ਰੈਨਾ ਨਾਲ ਗੋਤਮ ਗੰਭੀਰ ਆਰਾਮ ਨਾਲ ਖੇਡਦੇ ਰਹਿੰਦੇ ਹਨ ਚੌਕੇ ਛੱਕਿਆਂ ਦੀ ਮਦਦ ਨਾਲ ਉਹ ਸਤਾਨਵੇਂ ਰਨ 'ਤੇ ਪੁੱਜ ਜਾਂਦੇ ਹਨ ਸਤਾਨਵੇਂ ਰਨ ਪਾਰੀ ਖੇਡਣ ਤੋਂ ਬਾਅਦ ਉਹ ਜਦੋਂ ਇੱਕ ਸ਼ਾਰਟ ਮਾਰਨ ਦਾ ਟਰਾਈ ਕਰਦੇ ਹਨ ਤਾਂ ਉਹ ਕਲੀਨ ਬੋਲਡ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਸਟਰਾਈਕ 'ਤੇ ਆਉਂਦੇ ਹਨ ਰੈਨਾ ਅਤੇ ਐਮ ਐਸ ਧੋਨੀ ਧੋਨੀ ਉਸ ਟਾਈਮ 'ਤੇ ਕਪਤਾਨ ਹੁੰਦੇ ਹਨ ਟੀਮ ਦੇ ਉਹ ਆਉਂਦੇ ਹੀ ਤੇਜ਼ ਕਰ ਦਿੰਦੇ ਨੇ ਖੇਡ ਨੂੰ ਅਤੇ ਉਹ ਇਕਾਨਵੇਂ ਛਿਹੱਤਰ ਅਤੇ ਅਠੱਤਰ ਰਨ ਦੇ ਲਕਸ਼ ਇਹਦੀ ਪਾਰੀ ਖੇਡਦੇ ਹਨ ਜਿਸਦੇ ਕਰਕੇ ਮੈਚ ਭਾਰਤ ਦੀ ਝੋਲੀ 'ਚ ਬਹੁਤ ਆਰਾਮ ਨਾਲ ਆ ਜਾਂਦਾ ਅਤੇ ਭਾਰਤ ਸੱਤ ਤੋਂ ਅੱਠ ਗੇਂਦਾ ਰਹਿੰਦੇ ਹੀ ਜਿੱਤ ਜਾਂਦਾ ਪਰ ਉਸ ਮੈਚ ਦਾ ਸਾਰੇ ਨਾਲੋਂ ਵਧੀਆ ਅਨੁਭਵ ਸੀ ਜਦ ਆਖਰੀ ਲਾਸਟ ਸਕੋਰ ਮਾਰਨਾ ਸੀ ਤਾਂ ਧੋਨੀ ਨੇ ਸਟਰੇਟ ਇੱਕ ਛੱਕਾ ਮਾਰਿਆ ਜਿਸ ਤੋਂ ਬਾਅਦ ਰਵੀ ਸ਼ਾਸਤਰੀ ਨੇ ਬਹੁਤ ਹੀ ਬਹੁਤ ਹੀ ਫੀਲਿੰਗ ਜੋ ਕਿ ਇਮੋਸ਼ਨਲ ਫੀਲਿੰਗ ਸੀ ਭਾਵਨਾਵਾਂ ਸੀ ਉਸ ਵਿੱਚ ਆ ਕੇ ਕਿਹਾ ਸੀ ਕਿ ਆਫਟਰ ਟਵੰਟੀ ਏਟ ਈਅਰਸ ਇੰਡੀਆ ਲਿਫਟ ਦ ਵਰਲਡ ਕੱਪ ਇਹ ਸਭ ਸੁਣ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਉਦੋਂ ਮੇਰੀ ਉਮਰ ਸਿਰਫ ਨੌ ਸਾਲ ਸੀ ਅਤੇ ਮੈਨੂੰ ਇੰਨਾ ਚਾਅ ਸੀ ਕ੍ਰਿਕਟ ਦਾ ਕਿ ਮੈਂ ਪੂਰਾ ਮੈਚ ਦੇਖ ਕੇ ਸੋਇਆ ਅਤੇ ਉਹ ਦਿਨ ਮੇਰੇ ਲਈ ਬਹੁਤ ਯਾਦਗਾਰ ਹੈ